ਮੈਨੂੰ ਸਕੂਲ ਦੇ ਟਾਈਮ ਤੋਂ ਹੀ ਡਰਾਇੰਗ ਆਰਟ ਕਰਾਫਟ ਦਾ ਬਹੁਤ ਸ਼ੌਂਕ ਸੀਗਾ ਅਤੇ ਮੈਂ ਉਦੋਂ ਤੋਂ ਹੀ ਪੇਂਟਿੰਗ ਬਣਾਉਣਾ ਮੇਰਾ ਬਹੁਤ ਮੈਨੂੰ ਵਧੀਆ ਲੱਗਦਾ ਸੀਗਾ ਹੁਣ ਮੈਂ ਕੋਈ ਵੀ ਪੇਂਟਿੰਗ ਦੇਖਦੀ ਹਾਂ ਤਾਂ ਮੈਨੂੰ ਵਧੀਆ ਲੱਗਦੀ ਹੈ ਮੈਂ ਕੋਸ਼ਿਸ਼ ਕਰਦੀ ਹਾਂ ਕਰਦੀ ਉਹਨੂੰ ਬਣਾਉਣ ਦੀ ਅਤੇ ਜਿਹੜੀਆਂ ਮੈਨੂੰ ਚੁਣੌਤੀਆਂ ਆਈਆਂ ਉਹ ਇਹ ਸੀਗੀਆਂ ਕਿ ਕਈ ਵਾਰ ਕੋਈ ਚੀਜ਼ਾਂ ਬਣਾਉਂਦੇ ਬਣਾਉਂਦੇ ਗਲਤ ਹੋ ਜਾਂਦੀਆਂ ਸੀ ਤਾਂ ਫਿਰ ਉਨ੍ਹਾਂ ਨੂੰ ਸਹੀ ਕਰਨ ਵਾਸਤੇ ਸਾਰੀ ਦੁਵਾਰਾ ਤੋਂ ਸ਼ੁਰੂਆਤ ਕਰਨੀ ਪੈਂਦੀ ਸੀਗੀ ਇਸ ਕਰਕੇ ਇਸ ਕਰਕੇ ਮੈਂ ਪੇਂਟਿੰਗ ਤੋਂ ਇਹ ਹੀ ਸਿੱਖਿਆ ਆਪਣੀ ਚਿੱਤਰਕਾਰੀ ਤੋਂ ਕਿ ਗਲਤੀ ਕਰਨ ਤੋਂ ਪਹਿਲਾਂ ਬੰਦੇ ਨੂੰ ਸਾਰਾ ਕੁਛ ਦੇਖ ਲੈਣਾ ਚਾਹੀਦਾ ਕਿ ਕਿਤੇ ਮੇਰੀ ਕੋਈ ਗਲਤੀ ਤਾਂ ਨਹੀਂ ਹੋ ਰਹੀ ਹੈਗੀ